ਸਾਡੀ ਰਸੋਈ ਵਿੱਚ ਬਿਜਲੀ ਦੇ ਬਹੁਤ ਸਾਰੇ ਉਪਕਰਣ ਹਨ ਜਿਵੇਂ ਕਿ ਮਿਕਸਰ ਮਾਈਕਰੋਵੇਵ ਅਵਨ ਗਰਾਈਂਡਰ ਅਤੇ ਜੂਸ ਕੱਢਣ ਵਾਲੀ ਮਸ਼ੀਨ ਇੱਦਾਂ ਦੇ ਬਹੁਤ ਸਾਰੇ ਉਪਕਰਣ ਹਨ ਪੁਰਾਣੇ ਦਿਨਾਂ ਵਿੱਚ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ ਸਬਜ਼ੀਆਂ ਕੱਟਣ ਲਈ ਜਦੋਂ ਵੀ ਮਸਾਲਾ ਕੁੱਟਣਾ ਹੁੰਦਾ ਸੀ ਸਾਨੂੰ ਹੱਥਾਂ ਨਾਲ ਕਰਨਾ ਪੈਂਦਾ ਸੀ ਪਨ ਪਰ ਹੁਣ ਅਸੀਂ ਆਸਾਨੀ ਨਾਲ ਇਹ ਮਿਕਸਰ ਵਿੱਚ ਕਰ ਲੈਦੇ ਹਾਂ ਜੇ ਸਾਨੂੰ ਕਦੇ ਵੀ ਜੂਸ ਪੀਣ ਦੀ ਲੋੜ ਹੋਈ ਸਾਡੇ ਕੋਲ ਜੂਸ ਪੀਣ ਦੀ ਮ ਜੂਸ ਕੱਢਣ ਦੀ ਮਸ਼ੀਨ ਹੈਗੀ ਆ ਜਿਸ ਵਿੱਚ ਅਸੀਂ ਕੋਈ ਵੀ ਫਲ ਪਾਈਏ ਅਤੇ ਉਸ ਟਾਈਮ ਸਾਨੂੰ ਜੂਸ ਮਿਲ ਜਾਂਦਾ ਹੈ ਸਾਡੀ ਰਸੋਈ ਵਿੱਚ ਅਵਨ ਵੀ ਹੈਗਾ ਹੈ ਜਿਹਦੇ ਵਿੱਚ ਅਸੀਂ ਆਰਾਮ ਨਾਲ ਕੇਕ ਵੀ ਬਣਾ ਸਕਦੇ ਹਾਂ ਜੋ ਕਿ ਪਹਿਲਾਂ ਅਸੀਂ ਕੁੱਕਰ ਵਿੱਚ ਬਣਾਉਂਦੇ ਸੀ ਅਵਨ ਦੇ ਆਉਣ ਨਾਲ ਕਾਫ਼ੀ ਚੀ ਕਾਫ਼ੀ ਸਾਡੀ ਚੀਜ਼ਾਂ ਬਣਾਉਣੀਆਂ ਸੌਖੀ ਹੋ ਗਈਆਂ ਹਨ ਪਹਿਲਾਂ ਕੁੱਕਰ ਵਿੱਚ ਕਾਫ਼ੀ ਕਾਫ਼ੀ ਦੇਰ ਸਾਨੂੰ ਚੀਜ਼ਾਂ ਕਾਫ਼ੀ ਟਾਈਮ ਲਈ ਰੱਖਣੀ ਪੈਂਦੀਆਂ ਸੀਗੀਆਂ ਅਤੇ ਗੈਸ ਕੋਲ ਖੜ੍ਹੇ ਹੋਣਾ ਪੈਂਦਾ ਸੀਗਾ ਪਰ ਹੁਣ ਅਵਨ ਨਾਲ ਅਸੀਂ ਪਹਿਲਾਂ ਹੀ ਕਮਾਂਡ ਪਾ ਦਿੰਦੇ ਹਾਂ ਅਤੇ ਟਾਈਮ ਪਾ ਦਿੰਦੇ ਹਾਂ ਉਹ ਨਾਲ ਦੇ ਨਾਲ ਚੀਜ਼ ਬਣ ਕੇ ਆ ਜਾਂਦੀ ਹੈ ਹੁਣ ਹੁਣ ਦਾ ਤਜਰਬਾ ਕਾਫ਼ੀ ਸੌਖਾ ਹੈ ਪਹਿਲਾਂ ਨਾਲੋਂ